ਉਂਝ ਤਾਂ ਮੈਂ ਬਹੁਤ ਹੀ ਯਾਤਰਾਵਾਂ ਕੀਤੀਆਂ ਹੈਗੀਆਂ ਪਰ ਜੋ ਮੇਰੀ ਸਭ ਤੋਂ ਲੰਬੀ ਯਾਤਰਾ ਸੀਗੀ ਉਹ ਸੀਗੀ ਪੂਰਾ ਹਿਮਾਚਲ ਘੁੰਮਣਾ ਉਹ ਵੀ ਬਾਈਕ 'ਤੇ ਹਰ ਗਰਮੀਆਂ ਛੇਵੇਂ ਸੱਤਵੇਂ ਮਹੀਨੇ ਜਦੋਂ ਪੰਜਾਬ 'ਚ ਪੂਰੀ ਕੜਾਕੇ ਦੀ ਗਰਮੀ ਪੈਂਦੀ ਹੈ ਉਦੋਂ ਮੈਂ ਅਤੇ ਮੇਰੇ ਫਰੈਂਡ ਅਸੀਂ ਇੱਕ ਟੂਰ ਬਣਾਉਂਦੇ ਹੁੰਦੇ ਹਾਂ ਆਏ ਸਾਲ ਜਿਹੜਾ ਕੇ ਅਸੀਂ ਹਿਮਾਚਲ ਜਾਂ ਉੱਤਰਾਖੰਡ ਠੰਡੇ ਇਲਾਕੇ 'ਚ ਜਾ ਕੇ ਆਉਂਦੇ ਹੁੰਦੇ ਹੈਗੇ ਅਸੀਂ ਪਿਛਲੇ ਸਾਲ ਜਦੋਂ ਯਾਤਰਾ ਕੀਤੀ ਉਦੋਂ ਅਸੀਂ ਜੀ ਦਸ ਫਰੈਂਡ ਸੀਗੇ ਸਾਡੇ ਕੋਲ ਪੰਜ ਬਾਈਕ ਸੀਗੀਆਂ ਮੋਟਰ ਸਾਈਕਲ ਉਹ ਯਾਤਰਾ ਅਸੀਂ ਇੰਨੀ ਲੰਬੀ ਕੀਤੀ ਕਿ ਸਾਡੀ ਮੋਟਰ ਸਾਈਕਲ 'ਤੇ ਬੈਠੇ ਬੈਠੇ ਦੀ ਢੂਹੀ ਤੱਕ ਦੁਖਣ ਲੱਗ ਗੀ ਜੀ ਅਸੀਂ ਇੱਥੋਂ ਪੰਜਾਬ ਤੋਂ ਮੋਰਨਿੰਗ ਸੁਬਾਹ ਚੱਲੇ ਪੰਜ ਤੋਂ ਛੇ ਵਜੇ ਅਤੇ ਅਸੀਂ ਸ਼ਾਮ ਤੱਕ ਸ਼ਾਮ ਦੇ ਅੱਠ ਵਜੇ ਤੱਕ ਅਸੀਂ ਮੋਟਰ ਸਾਈਕਲ 'ਤੇ ਹੀ ਬੈਠੇ ਰਹੇ ਚਲਾਈ ਕਦੇ ਉਹਨੇ ਚਲਾ ਲਿਆ ਕਦੇ ਮੈਂ ਚਲਾ ਲਿਆ ਉਹ ਯਾਤਰਾ ਇੰਨੀ ਕੁ ਜ਼ਿਆਦਾ ਲੰਬੀ ਸੀ ਕਿਉਂਕਿ ਜੇ ਅਸੀਂ ਰੁੱਕਦੇ ਸੀਗੇ ਤਾਂ ਸਾਨੂੰ ਸਟੇਅ ਕਰਨੀ ਪੈਣੀ ਸੀਗੀ ਅਤੇ ਉਹਦੇ ਕਰਕੇ ਵੀ ਸਾਨੂੰ ਇੱਦਾਂ ਹੁੰਦਾ ਹਰ ਵਾਰ ਵੀ ਜਲਦੀ ਹਿਮਾਚਲ 'ਚ ਐਂਟਰ ਕਰੀਏ ਹਿਮਾਚਲ ਦੀ ਬੌਂਡਰੀ 'ਚ ਅਤੇ ਓੱਥੇ ਜਾ ਕੇ ਸਟੇਅ ਕਰੀਏ ਕਿਤੇ ਕਰਨਾ ਹੀ ਹੈ ਇੱਥੋਂ ਪੰਜਾਬ ਤੋਂ ਅਸੀਂ ਵਾਇਆ ਅੰਮ੍ਰਿਤਸਰ ਹੋ ਕੇ ਪਠਾਨਕੋਟ ਵਿੱਚ ਦੀ ਕਾਂਗੜਾ ਸਾਰਾ ਘੁੰਮਿਆ ਉਹ ਮਤਲਬ ਕੇ ਵੀ ਕੁਛ ਉੱਥੇ ਮੌਸਮ ਖਰਾਬ ਕਰਕੇ ਲਗਾਤਾਰ ਘੱਟੋਂ ਘੱਟ ਵੀ ਤਿੰਨ ਤਿੰਨ ਚਾਰ ਚਾਰ ਘੰਟੇ ਬਾਈਕ ਚਲਾਉਣੀ ਹੀ ਪੈਂਦੀ ਹੈਗੀ ਫਿਰ ਸਟੇਅ ਕਰਨੀ ਪੈਂਦੀ ਹੈ ਬਸ ਉਹ ਮੇਰੀ ਬਹੁਤ ਲੰਬੀ ਯਾਤਰਾ ਹੁੰਦੀ ਹੈ ਪਰ ਉਹ ਯਾਤਰਾ 'ਚ ਅਨੰਦ ਬਹੁਤ ਆਉਂਦਾ ਗਾ ਇਹ ਵੀ ਗੱਲ ਇੱਕ ਹੈ